ਮੈਂ ਭਵਿੱਖ ਵਿੱਚ ਸਿਖਲਾਈ ਸਿੱਖਣਾ ਸਿਖਲਾਈ 'ਚ ਪਲਾਜੋ ਸੂਟ ਸਿੱਖਣਾ ਚਾਹੁੰਦੀ ਹਾਂ ਕਿਉਂਕਿ ਪਹਿਲਾਂ ਪੁਰਾਣੇ ਜ਼ਮਾਨੇ ਵਿੱਚ ਪਹਿਲਾਂ ਸਲਵਾਰਾਂ ਪਾਉਦੇ ਸੀ ਫਿਰ ਉਸ ਤੋਂ ਬਾਅਦ ਪਟਿਆਲਾ ਸਲਵਾਰ ਚੱਲੀ ਪਰ ਹਾਂਜੀ ਪਟਿਆ ਮਤਲਬ ਸਲਵਾਰ ਹਜੇ ਵੀ ਪਾਉਂਦੇ ਨੇ ਬੱਟ ਬਹੁਤ ਜ਼ਿਆਦਾ ਘੱਟ ਪਾਉਂਦੇ ਨੇ ਅੱਜ ਕੱਲ੍ਹ ਫੈਂਸਨ ਪਲਾਜੋ ਦਾ ਚੱਲਿਆ ਪਹਿਲਾਂ ਪਜਾਮੇ ਵੀ ਚੱਲਦੇ ਸੀ ਫਿਰ ਉਹ ਵੀ ਘੱਟ ਗਿਆ ਹੁਣ ਪਲਾਜੋ ਬਹੁਤ ਜ਼ਿਆਦਾ ਹਰ ਜ਼ਮਾਨਾ ਬਦਲ ਗਿਆ ਅਤੇ ਹਰ ਕੋਈ ਪਲਾਜੋ ਪਾਉਂਦਾ ਹੈ ਇਸ ਲਈ ਮੈਨੂੰ ਪਲਾਜੋ ਸਿੱਖਣਾ ਚਾਹੁੰਦੀ ਹਾਂ ਮੈਂ ਪਲਾਜੋ ਹਰ ਤਰ੍ਹਾਂ ਦਾ ਪਲਾਜੋ ਸਿੱਖਣਾ ਚਾਹੁੰਦੀ ਹਾਂ ਪਲਾਜੋ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਪੈਂਟ ਪਲਾਜੋ ਖੁੱਲ੍ਹਾ ਪਲਾਜੋ ਮੈਂ ਹਰ ਤਰ੍ਹਾਂ ਦੇ ਪਲਾਜੋ ਸਿੱਖਣਾ ਚਾਹੁੰਦੀ ਹਾਂ ਕੋਈ ਪੇਂ ਪਲਾਜੋ ਦੇ ਨੀਚੇ ਲੈਸ ਲਗਵਾਉਂਦਾ ਕੋਈ ਮੋਟੀ ਲੈਸ ਲਗਵਾਉਂਦਾ ਕੋਈ ਪਾਈਪੀਨ ਲਗਵਾਉਂਦਾ ਕੋਈ ਨੀਚੇ ਬਟਨ ਲਗਵਾਉਂਦਾ ਕੋਈ ਨੀਚੋਂ ਜਿੱਪ ਵਗੈਰਾ ਲਗਵਾ ਕੇ ਪਲਾਜੋ ਖੁੱਲ੍ਹੇ ਹਰ ਤ ਵੀ ਨਵੇਂ ਤੋਂ ਨਵੇਂ ਫੈਸ਼ਨ ਆਪਣੇ ਜ਼ਮਾਨੇ ਵਿੱਚ ਹੁਣ ਉੱਭਰ ਰਹੇ ਨੇ ਇਸ ਲਈ ਮੈਂ ਹੁਣ ਹਰ ਤਰ੍ਹਾਂ ਦਾ ਪਲਾਜੋ ਸਿੱਖਣਾ ਚਾਹੁੰਦੀ ਹਾਂ ਤਾਂ ਕਿ ਮੈਂ ਭਵਿੱਖ ਵਿੱਚ ਆਪਣੇ ਸੂਟ ਸਿਉ ਸਕਾਂ ਅਤੇ ਆਪਣੇ ਸੂਟ ਸੋਹਣੇ ਤੋਂ ਸੋਹਣੇ ਬਣਾ ਸਕਾਂ ਪਲਾਜੋ ਪਲਾਜੋ ਸੂਟਾਂ ਨੂੰ ਅਤੇ ਸੋਹਣੇ ਤੋਂ ਸੋਹਣਾ ਬਣਾ ਕੇ ਆਪਣਾ ਸਟਿਚ ਕਰਕੇ ਪਾ ਸਕਾਂ